ਅੱਜ ਭਾਰਤ ਦੇ ਵਾਤਾਵਰਨ ਦੇ ਵਿੱਚ ਬਹੁਤ ਵੱਡੇ ਬਦਲਾਅ ਹੋ ਰਹੇ ਨੇ ਜਿਵੇਂ ਕਿ ਆਪਾਂ ਗੱਲ ਕਰੀਏ ਪਿਛਲੀ ਵਾਰ ਸਰਦੀ ਦੇ ਵਿੱਚ ਬਹੁਤ ਜ਼ਿਆਦਾ ਭਿਆਨਕ ਸਰਦੀ ਪਈ ਸੀ ਜਿਸ ਦੇ ਨਾਲ ਜਿਹੜਾ ਨਿੰਮ ਆ ਨੀਮ ਨਿੰਮ ਸਾਰੀ ਸੁੱਕ ਗਈ ਅੱਜ ਤੱਕ ਉਹ ਥੋੜ੍ਹੇ ਬਹੁਤੇ ਹੀ ਨਿੰਮ ਜਿਹੜੇ ਦੁਬਾਰੇ ਹਰੇ ਹੋਏ ਨੇ ਨਹੀਂ ਇੰਨੀ ਜ਼ਿਆਦਾ ਸਰਦੀ ਪਈ ਆ ਕਿ ਸਾਰੇ ਨਿੰਮ ਸੁੱਕ ਚੁੱਕੇ ਨੇ ਦਰੱਖਤ ਸੀ ਜਿਹੜੇ ਨਿੰਮ ਦੇ ਅਤੇ ਹੁਣ ਗਰਮੀ ਦੀ ਗੱਲ ਕਰੀਏ ਗਰਮੀ ਵੀ ਬਹੁਤ ਜ਼ਿਆਦਾ ਅੱਤ ਪਈ ਹੈ ਗਰਮੀ ਦੀ ਗਰਮੀ ਦੇ ਕਾਰਣ ਬਹੁਤ ਲੋਕਾਂ ਦੀ ਮੌਤ ਹੋ ਚੁੱਕੀ ਹੈ ਫਿਰ ਆਪਾਂ ਨਦੀਆਂ ਨਾਲਿਆਂ ਦੀ ਗੱਲ ਕਰੀਏ ਉਹਨਾਂ ਦਾ ਬਿਲਕੁਲ ਪਾਣੀ ਹੈ ਜਿਹੜਾ ਦੂਸ਼ਿਤ ਹੋ ਚੁੱਕਿਆ ਜੰਗਲੀ ਜਾਨਵਰ ਪਾਣੀ ਪੀਣ ਕਾਰਣ ਕਿ ਬਹੁਤ ਮਰੇ ਨੇ ਪਾਣੀ 'ਚ ਰਹਿੰਦੀਆਂ ਮੱਛੀਆਂ ਅਤੇ ਹੋਰ ਜਾਨਵਰ ਦੀ ਬਹੁਤ ਮੌਤ ਹੁੰਦੀ ਆ ਆਏ ਸਾਲ ਬਹੁਤ ਜ਼ਿਆਦਾ ਮੌਤਾਂ ਹੁੰਦੀਆਂ ਨੇ ਅਤੇ ਜਿਹੜਾ ਇਨਵਾਇਰਨਾਮੈਂਟ ਆ ਹਵਾ ਦਾ ਉਹ ਵੀ ਬਹੁਤ ਚੇਂਜ ਹੋ ਗਿਆ ਬਹੁਤ ਬਦਲ ਗਿਆ ਜਿਨ੍ਹਾਂ ਲੋਕਾਂ ਨੂੰ ਬੜੀਆਂ ਭਿਆਨਕ ਬਿਮਾਰੀਆਂ ਲੱਗ ਰਹੀਆਂ ਨੇ ਅਤੇ ਖੇਤਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜੀ ਰੇਹਾਂ ਸਪਰੇਹਾਂ ਯੂਜ ਹੁੰਦੀਆਂ ਉਹਦੇ ਨਾਲ ਵੀ ਵਾਤਾਵਰਨ ਬਹੁਤ ਖਰਾਬ ਹੋ ਗਿਆ ਦਿਨੋਂ ਦਿਨ ਜਿਹੜਾ ਇਨਵਾਇਰਨਾਮੈਂਟ ਆ ਵਾਤਾਵਰਨ ਉਹ ਖਰਾਬ ਹੁੰਦਾ ਜਾ ਰਿਹਾ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਬਹੁਤ ਜ਼ਿਆਦਾ ਬਦਲਾਅ ਗਾ ਅਤੇ ਲੋਕਾਂ ਨੂੰ ਬੜੀਆਂ ਭਿਆਨਕ ਬਿਮਾਰੀਆਂ ਲੱਗ ਰਹੀਆਂ ਨੇ